ਦਿਵਾਲੀ ਦਾ ਤਿਉਹਾਰ ਹਿੰਦੂ ਸਿੱਖ ਦਾ ਸਾਂਝਾ ਤਿਉਹਾਰ ਹੈ ਅਸੀਂ ਇਸ ਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾਉਂਦੇ ਹਾਂ ਇਸ ਦੀ ਤਿਆਰੀ ਪੰਦਰਾਂ ਪੰਦਰਾਂ ਦਿਨ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਹੈ ਅਸੀਂ ਘਰਾਂ ਵਿੱਚ ਪੂਰੀ ਤਰ੍ਹਾਂ ਸਫਾਈ ਕਰਦੇ ਹਨ ਕਰਦੇ ਹਾਂ ਵਾਈਟ ਵਾਸ਼ ਕਰਾਉਂਦੇ ਹਾਂ ਅਤੇ ਹਰ ਤਰ੍ਹਾਂ ਨਾਲ ਘਰਾਂ ਨੂੰ ਸਾਫ਼ ਕਰਦੇ ਹਾਂ ਅਤੇ ਇਸ ਜਦੋਂ ਇਹ ਤਿਉਹਾਰ ਆਉਂਦਾ ਹੈ ਅਸੀਂ ਇਸ ਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾਉਂਦੇ ਹਾਂ ਇਸ ਦਿਨ ਸ਼੍ਰੀ ਰਾਮ ਚੰਦਰ ਜੀ ਚੌਦਾਂ ਸਾਲ ਦਾ ਬਨਵਾਸ ਕੱਟ ਕੇ ਅਯੁੱਧਿਆ ਵਾਪਸ ਆਏ ਸਨ ਇਸ ਖੁਸ਼ੀ ਵਿੱਚ ਦਿਵਾਲੀ ਮਨਾਈ ਮਨਾਈ ਜਾਂਦੀ ਹੈ ਇਸੇ ਤਰ੍ਹਾਂ ਸਿੱਖ ਧਰਮ ਵਿੱਚ ਵੀ ਗੁਰੂ ਹਰਗੋਬਿੰਦ ਸਾਹਿਬ ਗਆਲੀਅਰ ਦੇ ਕਿਲ੍ਹੇ 'ਚੋਂ ਬਵੰਜਾ ਰਾਜਿਆਂ ਨੂੰ ਰਿਹਾਅ ਕਰਵਾ ਕੇ ਆਏ ਸਨ ਅਤੇ ਇਸ ਖੁਸ਼ੀ ਵਿੱਚ ਸੰਗਤ ਨੇ ਦੀਪਮਾਲਾ ਅਤੇ ਆਤਿਸ਼ਬਾਜ਼ੀ ਕੀਤੀ ਸੀ ਇਹ ਤਿਉਹਾਰ ਇਸ ਇਸ ਦਿਨ ਅਸੀਂ ਬਰਤਨ ਆਦਿ ਖਰੀਦਦੇ ਹਾਂ ਅਤੇ ਇਸ ਦਿਨ ਪਟਾਕੇ ਵਗੈਰਾ ਖਰੀਦੇ ਜਾਂਦੇ ਹਨ ਜੋ ਕਿ ਰਾਤ ਨੂੰ ਚਲਾਏ ਜਾਂਦੇ ਹਨ ਅਤੇ ਆਨੰਦ ਮਾਣਿਆ ਜਾਂਦਾ ਹੈ ਇਸ ਦਿਨ ਅਸੀਂ ਤਰ੍ਹਾਂ ਤਰ੍ਹਾਂ ਦੀਆਂ ਮਠਿਆਈਆਂ ਲਿਆਉਦੇ ਹਾਂ ਅਤੇ ਅਤੇ ਸਾਰੇ ਪਰਿਵਾਰ ਨਾਲ ਮਿਲ ਕੇ ਖਾਂਦੇ ਹਾਂ ਅਤੇ ਇਸ ਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾਉਂਦੇ ਹਾਂ ਥੈਂਕ ਯੂ